ਮੇਰੇ ਪਿੰਡ ਵਿੱਚ ਅਲੱਗ ਅਲੱਗ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਪਿਆਰ ਹੈ ਜਿਵੇਂ ਕਿ ਗੁਰੂ ਇਮਾਮ ਪੁਜਾਰੀ ਭਿਕਸ਼ੂ ਅਤੇ ਨਾਲ ਹੀ ਨਾਲ ਮੇਰੇ ਇਲਾਕੇ ਵਿੱਚ ਬਾਬਾ ਮਨਮੋਹਣ ਮਨਮੋਹਣ ਸਿੰਘ ਜੀ ਹਨ ਜੋ ਕਿ ਬਹੁਤ ਹੀ ਜ਼ਿਆਦਾ ਮਸ਼ਹੂਰ ਹਨ ਕਿਉਂਕਿ ਉਹ ਆਪਣੇ ਨਾਲ ਚਾਰ ਗੰਨਮੈਨ ਰੱਖਦੇ ਹਨ ਅਤੇ ਨਾਲ ਹੀ ਉਹ ਲੋਕਾਂ ਨੂੰ ਗੁਰੂ ਲਈ ਜੁੜਨ ਲਈ ਪ੍ਰੇਰਿਤ ਕਰਦੇ ਹਨ ਅਤੇ ਨਾਲ ਹੀ ਨਾਲ ਉਹਨਾਂ ਦੀਆਂ ਗੱਲਾਂ ਮੈਨੂੰ ਬਹੁਤ ਹੀ ਜ਼ਿਆਦਾ ਮੋਟੀਵੇਟ ਕਰਦੀਆਂ ਹਨ ਜਿਸ ਕਰਕੇ ਮੈਂ ਉਹਨਾਂ ਨੂੰ ਬਹੁਤ ਹੀ ਜ ਜ਼ਿਆਦਾ ਪਸੰਦ ਕਰਦਾ ਹਾਂ ਅਤੇ ਮੇਰੇ ਇਲਾਕੇ ਦੇ ਲੋਕ ਵੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ